ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਮੈਂ ਤੁਹਾਡੇ ਰੈਸਟੋਰੈਂਟ ਦਾ ਯੈਲੋ ਚੀਲੀ ਵਿੱਚੋਂ ਆਪਣਾ ਔਡਰ ਕੀਤਾ ਸੀ ਜਿਸ ਵਿੱਚ ਮੈਨੇ ਬਰਗਰ ਪੀਜ਼ਾ ਨੂਡਲ ਫਰੈਂਚ ਫਰਾਈਜ਼ ਅਤੇ ਕੋਕ ਦਾ ਵੀ ਔਡਰ ਨਾਲ਼ ਦਿੱਤਾ ਸੀ ਪਰ ਮੈਨੂੰ ਇਸ ਡਿਲੀਵਰੀ ਵਿੱਚ ਆਪਣਾ ਕੋਲਡਿੰਕ ਨਹੀਂ ਰਿਸੀਵ ਹੋਇਆ ਹੈ ਕਿਰਪਾ ਕਰਕੇ ਜਾਂ ਤਾਂ ਮੈਨੂੰ ਮੇਰੇ ਪੈਸੇ ਦੇ ਦਿੱਤੇ ਜਾਣ ਅਤੇ ਜਾਂ ਤਾਂ ਮੇਰੇ ਘਰ ਇਹ ਚਾਲੀ ਮਿੰਟ ਦੇ ਅੰਦਰ ਅੰਦਰ ਡਿਲੀਵਰ ਕੀਤਾ ਜਾਵੇ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ